ਸਾਈਕਲ ਚਲਾਉਣ ਸਮੇਂ ਸਾਨੂੰ ਖੱਬੇ ਅਤੇ ਸੱਜੇ ਪਾਸੇ ਦਾ ਧਿਆਨ ਰੱਖਣਾ ਚਾਹੀਦਾ ਹੈ ਸਾਨੂੰ ਆਪਣੇ ਖੱਬੇ ਪਾਸੇ ਸਾਈਕਲ ਚਲਾਉਣੀ ਚਾਹੀਦੀ ਹੈ ਅਗਰ ਅਸੀਂ ਸਾਈਕਲ ਚਲਾਉਣ ਵੇਲੇ ਪੂਰਾ ਡਿਸੀਪਲੀਨ ਬਣਾ ਕੇ ਰੱਖਦੇ ਹਾਂ ਤਾਂ ਐਕਸੀਡੈਂਟ ਹੋਣ ਦੇ ਚਾਂਸਿਸ ਬਹੁਤ ਜ਼ਿਆਦਾ ਘੱਟ ਹੁੰਦੇ ਹਨ ਅਗਰ ਅਸੀਂ ਡਿਸੀਪਲੀਨ ਨਹੀਂ ਬਣਾ ਕੇ ਰੱਖਦੇ ਤਾਂ ਐਕਸੀਡੈਂਟ ਹੋਣ ਦੀ ਸੰਭਾਵਨਾ ਵੱਧ ਜਾਂਦੀ ਹੈ ਹਮੇਸ਼ਾ ਸਾਨੂੰ ਸਾਈਕਲ ਸਲੋ ਚਲਾਉਣੀ ਚਾਹੀਦੀ ਹੈ ਭੀੜ ਭਾੜ ਵਾਲੇ ਇਲਾਕੇ ਵਿੱਚ ਸਾਨੂੰ ਪੂਰਾ ਧਿਆਨ ਰੱਖਣਾ ਚਾਹੀਦਾ ਹੈ ਅਤੇ ਸਾਈਕਲ ਦੀ ਰਫਤਾਰ ਵੀ ਹੌਲੀ ਰੱਖਣੀ ਚਾਹੀਦੀ ਹੈ ਅਗਰ ਅਸੀਂ ਨੇ ਅੱਗੇ ਮੋੜ ਕੱਟਣਾ ਜਾਂ ਮੋੜ ਮੋੜਨਾ ਤਾਂ ਸਾਨੂੰ ਦੋਨੋਂ ਤਰਫ ਝਾਕਣਾ ਚਾਹੀਦਾ ਹੈ ਵੀ ਕੋਈ ਵਹੀਕਲ ਜਾਂ ਵਾਹਨ ਸਾਡੀ ਤਰਫ ਆ ਤਾਂ ਨਹੀਂ ਰਿਹਾ ਅਗਰ ਕੋਈ ਵਹੀਕਲ ਜਾਂ ਵਾਹਨ ਸਾਡੇ ਤਰਫ ਨਹੀਂ ਆ ਰਿਹਾ ਤਾਂ ਆਪਾਂ ਜਿੱਧਰ ਜਾਣਾ ਚਾਹੁੰਦੇ ਹਾਂ ਉੱਧਰ ਨੂੰ ਸਾਈਕਲ ਮੋੜ ਸਕਦੇ ਹਾਂ